ਹਾਂਜੀ ਹਾਂਜੀ ਪੁੱਛੋ ਹਾਂਜੀ ਕ੍ਰਿਕਟ ਹੋ ਗਿਆ ਬੈਡਮਿੰਟਨ ਹੋ ਗਿਆ ਹੋਕੀ ਹੋ ਗਈ ਕਬੱਡੀ ਹੋ ਗਈ ਇਹੀ ਗੇਮਾਂ ਜ਼ਿਆਦਾ ਪ੍ਰਸਿੱਧ ਹਨ ਸਾਡੇ ਸਕੂਲ ਵਿੱਚ ਕ੍ਰਿਕਟ ਦੀ ਵੀ ਦਿੱਤੀ ਜਾਂਦੀ ਹੈ ਹੋਕੀ ਦੀ ਵੀ ਦਿੱਤੀ ਜਾਂਦੀ ਹੈ ਸਾਡੇ ਉਹ ਤੀਜੇ ਪੀਰੀਅਡ ਵਿੱਚ ਦਿੱਤੀ ਜਾਂਦੀ ਹੈ ਉਸ ਟਾਈਮ 'ਤੇ ਸਾਡੇ ਕੋਚਿੰਗ ਸਰ ਆਏ ਹੁੰਦੇ ਹੈ ਇਸ ਕਰਕੇ ਉਹੀ ਸਾਰਿਆਂ ਨੂੰ ਕੁਛ ਸਿਖਾਉਂਦੇ ਆ ਇੱਥੇ ਨਹੀਂ ਨਹੀਂ ਉੱਥੇ ਤੁਸੀਂ ਐਡਮਿਸ਼ਨ ਕਰਵਾਓਗੇ ਤਾਂ ਉੱਥੇ ਤੁਹਾਨੂੰ ਫਾਰਮ ਮਿਲੇਗਾ ਉਹਨੂੰ ਫਿਲ ਕਰਨਾ ਪੈਂਦਾ ਅਤੇ ਉਹਦੇ ਨਾਲ ਹੀ ਫਿਰ ਤੁਹਾਨੂੰ ਤੁਹਾਡੀ ਪਰੈਕਟੀਸ ਸ਼ੁਰੂ ਕੀਤੀ ਜਾਏਗੀ ਚਾਰਜਿਸ ਸਟਾਰਟਿੰਗ ਪਹਿਲੇ ਉਹਨਾਂ ਨੇ ਤੁਹਾਡੇ ਕੋਲ ਫਾਈਵ ਹੰਡਰਡ ਲੈਣੇ ਹੈ ਉਸ ਤੋਂ ਬਾਅਦ ਜੇ ਤੁਸੀਂ ਕਰੋਂਗੇ ਫਿਰ ਤੁਹਾਡੀ ਟੀਮ ਸਿਲੈਕਟ ਹੋਏਗੀ ਉਸ ਤੋਂ ਬਾਅਦ ਬਾਕੀ ਤੁਹਾਨੂੰ ਦੱਸਿਆ ਜਾਏਗਾ ਹਾਂਜੀ ਹਾਂਜੀ ਬਾਅਦ 'ਚ ਉਹਨਾਂ ਵੀ ਲੱਗਦੇ ਹੈ ਮੁਕਾਬਲੇ ਹੁੰਦੇ ਉਹਨਾਂ ਦੇ ਫਿਰ ਉਹਦੇ ਵਿੱਚ ਸਿਲੈਕਟ ਕਰਦੇ ਹੈ ਕਿਹੜਾ ਕਿਹਨੇ ਚੰਗਾ ਕੀਤਾ ਓਕੇ ਓਕੇ ਬਾਏ